ਅਠਾਰ੍ਹਾਂ ਮਾਰਚ ਉੱਨੀ ਸੌ ਨੜਿਨਵੇਂ ਤਿੰਨ ਸਤੰਬਰ ਦੋ ਹਜ਼ਾਰ ਚਾਰ ਤੇਈ ਦਸੰਬਰ ਉੱਨੀ ਸੌ ਨੜਿਨਵੇਂ ਉਨੱਤੀ ਜੂਨ ਦੋ ਹਜ਼ਾਰ ਗਿਆਰ੍ਹਾਂ ਸੋਲ੍ਹਾਂ ਅਗਸਤ ਦੋ ਹਜ਼ਾਰ ਪੰਜ